ਮੈਂ ਨਵਾਂ ਸ਼ਹਿਰ ਵਿੱਚ ਰਹਿੰਦਾ ਇੱਥੇ ਬਹੁਤ ਸਾਰੇ ਮਤਲਬ ਕਿ ਇੱਦਾਂ ਦੇ ਏਰੀਏ ਨਹੀਂ ਹੈ ਜਿੱਥੇ ਜੰਗਲ ਵਗੈਰਾ ਇੱਦਾਂ ਦੀਆਂ ਚੀਜ਼ਾਂ ਹੋਵੇ ਵੈਸੇ ਥੋੜ੍ਹੀਆਂ ਜਿਹੀਆਂ ਹੈਗੀਆਂ ਛੋਟੀਆਂ ਛੋਟੀਆਂ ਪਹਾੜੀਆਂ ਹੈਗੀਆਂ ਨੇ ਜਦੋਂ ਕਿ ਅਸੀਂ ਰੋਪੜ ਤੋਂ ਨਾਲ ਹੀ ਨਿਕਲਦੇ ਨੇ ਉਹ ਸਾ ਪਹਿਲਾਂ ਸਤਲੁਜ ਦਰਿਆ ਆਉਂਦਾ ਸਤਲੁਜ ਦਰਿਆ ਦੇ ਨਾਲ ਹੀ ਛੋਟੀਆਂ ਛੋਟੀਆਂ ਜਿਹੜੀਆਂ ਪਹਾੜੀਆਂ ਆਉਂਦੀਆਂ ਨੇ ਇਹ ਗੱਲ ਕੀਤੀ ਜਾਵੇ ਇਹਨਾਂ ਦੀ ਇਹਨਾਂ ਵਿੱਚੋਂ ਮਤਲਬ ਕਿ ਜਿਹੜਾ ਸਤਲੁਜ ਦਰਿਆ ਉਸ ਤੋਂ ਦੂਜੀ ਸਾਈਡ ਇੱਕ ਸਾਈਡ ਰੋਪੜ ਰਹਿ ਜਾਂਦਾ ਹੈ ਅਤੇ ਦੂਜੀ ਸਾਈਡ ਸਾਡਾ ਨਵਾਂ ਸ਼ਹਿਰ ਸਟਾਰਟ ਹੋ ਜਾਂਦਾ ਇਹਦੇ ਵਿੱਚ ਮਤਲਬ ਕਿ ਬਹੁਤ ਘੱਟ ਮਤਲਬ ਕਿ ਹੁਣ ਤਾਂ ਜਾਨਵਰ ਰਹਿ ਗਏ ਨੇ ਹੁਣ ਤਾਂ ਜ਼ਿਆਦਾਤਰ ਗਊਆਂ ਹੀ ਮਿਲਦੀਆਂ ਨੇ ਜਾਂ ਉਹ ਬਾਂਦਰ ਹੋ ਗਏ ਕਦੇ ਕਦੇ ਹੁੰ ਹੁੰਦਾ ਹੈ ਵੀ ਤੇਂਦੂਆ ਵਗੈਰਾ ਵੀ ਦਿਖ ਜਾਵੇ ਵੈਸੇ ਇਹਨਾਂ ਦੀ ਬਹੁਤ ਘੱਟ ਗਿਣਤੀ ਰਹਿ ਗਈ ਹੈ ਜਿਸ ਕਾਰਨ ਇਹ ਸਾਨੂੰ ਹੁਣ ਇੰਨੇ ਦਿਖਦੇ ਨਹੀਂ ਹੈਗੇ ਜ਼ਿਆਦਾਤਰ ਸਾਨੂੰ ਬਾਂਦਰ ਹੋ ਗਏ ਕੁੱਤੇ ਹੋ ਗਏ ਜਾਂ ਆਪਣੇ ਹਿਰਨ ਹੋ ਗਏ ਜਾਂ ਨੀਲ ਗਊਆਂ ਹੋ ਗਈਆਂ ਇੱਦਾਂ ਦੇ ਜਾਨਵਰ ਦਿਖਦੇ ਨੇ